ਹਾਂਜੀ ਲੰਬੀ ਬਾਈਕਿੰਗ ਯਾਤਰਾ ਅਤੇ ਟੂਰ ਦੇ ਲਈ ਅਸੀਂ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੁੰਦੇ ਹਾਂ ਜਿਵੇਂ ਕਿ ਅਸੀਂ ਸਭ ਤੋਂ ਪਹਿਲਾਂ ਪੈਕਿੰਗ ਕਰਦੇ ਹਾਂ ਆਪਣੇ ਜਿੱਦਾਂ ਠੰਡ ਵਾਲੀ ਜਗ੍ਹਾ 'ਤੇ ਜਾ ਰਹੇ ਹਾਂ ਸਰਦੀ ਵਾਲੀ ਜਗ੍ਹਾ 'ਤੇ ਜਾ ਰਹੇ ਹਾਂ ਤਾਂ ਉੱਥੇ ਅਸੀਂ ਆਪਣੇ ਦੋ ਕੋਟ ਜੇ ਤਿੰਨ ਸਾਡਾ ਟ੍ਰਿਪ ਸਾਡਾ ਚਾਰ ਦਿਨਾਂ ਦਾ ਤਾਂ ਉਹਦੇ ਵਿੱਚ ਸਾਡਾ ਦੋ ਕੋਟ ਹੋਣਗੇ ਗਰਮ ਸ਼ਰਟਾਂ ਹੋਣਗੀਆਂ ਅੰਦਰ ਨੂੰ ਪਾਉਣ ਵਾਸਤੇ ਇਨਰ ਅਤੇ ਦੋ ਸਲੈਕਸਾਂ ਅੰਡਰਵੀਅਰ ਜੀਆਂ ਵਗੈਰਾ ਅਤੇ ਉਹ ਮਤਲਬ ਵੀ ਪੂਰਾ ਸਾਡਾ ਇੱਕ ਪਲੈਨ ਜਿਹੜਾ ਬਣਿਆ ਹੁੰਦਾ ਚਾਰ ਦਿਨਾਂ ਦਾ ਉਹਦੇ ਲਈ ਅਸੀਂ ਸਭ ਤੋਂ ਪਹਿਲਾਂ ਸਾਡੀ ਪੋਕਟ ਮਨੀ ਹੁੰਦੀ ਆ ਦਸ ਹਜ਼ਾਰ ਜਾਂ ਬਾਰਾਂ ਹਜ਼ਾਰ ਜੇ ਚਾਰ ਦਿਨਾਂ ਦਾ ਟ੍ਰਿਪ ਆ ਜੇ ਸਾਡਾ ਛੇ ਦਿਨਾਂ ਦਾ ਟ੍ਰਿਪ ਆ ਤਾਂ ਉੱਥੇ ਸਾਨੂੰ ਪੰਦਰਾਂ ਜਾਂ ਅਠਾਰਾਂ ਹਜ਼ਾਰ ਰੁਪਈਆ ਸਾਡੇ ਕੋਲ ਹੋਣਾ ਜ਼ਰੂਰੀ ਆ ਅਤੇ ਉਹਦੇ ਵਿੱਚੋਂ ਫਿਰ ਅਸੀਂ ਆਪਣੀ ਬਾਈਕ ਦੀ ਸਰਵਿਸ ਵਗੈਰਾ ਕਰਵਾ ਕੇ ਚੰਗੀ ਤਰ੍ਹਾਂ ਚੈੱਕ ਕਰਵਾ ਕੇ ਛੋਕਰ ਵਗੈਰਾ ਸੈੱਟ ਐਨ ਪੂਰੀ ਤਰ੍ਹਾਂ ਪੁਆ ਕੇ ਨਵਾਂ ਚੈਨ ਸੈੱਟ ਪੁਆ ਕੇ ਫਿਰ ਅਸੀਂ ਲੰਬੇ ਟੂਰ 'ਤੇ ਵੱਲ ਯਾਤਰਾ ਟੂਰ ਕਰਦੇ ਹਾਂ ਅਤੇ ਇਸ ਤੋਂ ਬਾਅਦ ਅਸੀਂ ਲੇਹ ਲਦਾਖ ਵੀ ਜਾ ਕੇ ਆਏ ਹਾਂ ਲੇਹ ਲਦਾਖ ਦੇ ਵਿੱਚ ਵੀ ਸਾਡਾ ਸੇਮ ਇੱਦਾਂ ਦਾ ਹੀ ਪ੍ਰੋਸੀਜਰ ਸੀਗਾ